ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਂਜੀ ਹਾਂਜੀ ਠੀਕ ਹੈ ਕੀ ਹਾਲ ਚਾਲ ਹੈ ਬੱਚੇ ਕਿੱਦਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਸੈਕਿੰਡ ਵਿੱਚ ਹੀ ਆ ਹਾਂਜੀ ਜਲੰਧਰ ਵਿੱਚ ਸਕੂਲ ਇੱਦਾਂ ਹੈ ਕਿ ਸਕੂਲ ਇਧਰ ਸਾਡੀ ਸਾਈਡ ਵਿੱਚ ਹੈਗਾ ਆ ਸਾਡੇ ਨੀਅਰ ਹੀ ਹੈ ਸਾਡੇ ਨੇੜੇ ਆ ਹੈਗਾ ਆ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਮੈਂ ਨਾ ਇੱਕ ਵਾਰੀ ਗਈ ਸੀ ਕਰਵਾਉਂਦੇ ਆ ਨਾਲ ਰਿਲੇਟਿਡ ਵੀ ਆ ਅਤੇ ਉੱਥੇ ਸਟਡੀ ਆ ਮੈਨੂੰ ਉਹਨਾਂ ਦੇ ਪੇਰੈਂਟਸ ਨੇ ਦੱਸਿਆ ਕਿ ਉੱਥੇ ਪੜ੍ਹਾਈ ਬਹੁਤ ਵਧੀਆ ਇਸ ਕਰਕੇ ਤੁਸੀਂ ਆਪਣਾ ਬੱਚਾ ਉੱੱਥੇ ਲਗਾਓ

ਹਾਂਜੀ ਬੱਚੇ ਪਾਠ ਆਪਣੇ ਆਪ ਕਰਦੇ ਆ ਹਾਂਜੀ ਪਾਠ ਕਰਦੇ ਬੱਚੇ ਅਰਦਾਸ ਕਰਦੇ ਆ ਕੀਰਤਨ ਕਰਦੇ ਉਹ ਆਪ ਇਸ ਕਰਕੇ ਸਾਡੇ ਬੱਚਿਆਂ ਲਈ ਉਹ ਸਭ ਨਾਲੋਂ ਵਧੀਆ ਸਕੂਲ ਹੈ ਹਾਂਜੀ ਹਾਂਜੀ ਮੈਂ ਸਕੂਲ ਗਈ ਸੀ ਇੱਕ ਵਾਰੀ ਅਤੇ ਮੈਨੂੰ ਹਾਂਜੀ ਹਾਂਜੀ ਮੈਨੂੰ ਮਾਪਿਆਂ ਨੇ ਦੱਸਿਆ ਕਿ ਸਾਡੇ ਬੱਚਾ ਉਸ ਸਕੂਲ ਦੀ ਪੜ੍ਹਾਈ ਬਹੁਤ ਵਧੀਆ ਹੈ ਇਸ ਕਰਕੇ ਫਿਰ ਮੇਰਾ ਵੀ ਮਨ ਮੰਨਿਆ ਕਿ ਮੈਂ ਆਪਣਾ ਬੱਚਾ ਵੀ ਉੱਥੇ ਹੀ ਲਗਾਵਾਂ ਸਟਾਫ ਬਹੁਤ ਵਧੀਆ

ਉੱਥੇ ਪੰਜਾਬੀ ਹਾਂਜੀ ਹਾਂਜੀ ਬਸ ਮੇਰਾ ਵੀ ਮਨ ਵੀ ਇਹੀ ਕਹਿ ਰਿਹਾ ਕਿ ਅਸੀਂ ਬੱਚਿਆਂ ਨੂੰ ਹਾਂਜੀ ਹਾਂਜੀ ਆਪਾਂ ਫਿਰ ਚੱਲਿਓ ਹਾਂਜੀ ਹਾਂਜੀ ਆਪਾਂ ਕਿਸੇ ਦਿਨ ਜਾਵਾਂਗੇ ਅਤੇ ਤੁਸੀਂ ਮੈਨੂੰ ਕੋਲ ਕਰ ਲੈਣਾ ਆਪਾਂ ਫਿਰ ਹਾਂਜੀ ਹਾਂਜੀ ਹਾਂਜੀ ਠੀਕ ਹੈ ਆਪਾਂ ਕੱਲ੍ਹ ਚਲਾਂਗੇ ਟਾਈਮ ਤੁਸੀਂ ਦੱਸ ਦੋ ਕਿੰਨੇ ਵਜੇ ਜਾਣਾ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਆਪਾਂ ਇਥੇ ਤੁਸੀਂ ਹੋਰ ਕਿਤੇ ਪ੍ਰੋਗਰਾਮ ਨਾ ਬਣਾਈਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ